ਜਿਹੜੇ ਲੋਕ ਚਿੱਤਰਕਾਰੀ ਨਾਲ ਜੁੜਦੇ ਹਨ ਉਹਨਾਂ ਨੂੰ ਅਕਸਰ ਹੀ ਪਹਿਲਾਂ ਪਹਿਲਾਂ ਇਹ ਲੱਗਦਾ ਹੈ ਕਿ ਜਿਹੜੇ ਚਿੱਤਰਕਾਰੀ ਦੇ ਵਿੱਚ ਜਿਹੜੇ ਰੰਗ ਨੇ ਅਗਰ ਉਹ ਮਹਿੰਗੇ ਵਰਤਣਗੇ ਜਾਂ ਫਿਰ ਜਿਹੜੇ ਉਹ ਪੇਂਟ ਬਰੱਸ਼ਿਸ਼ ਲੈਂਦੇ ਨੇ ਉਹ ਅਗਰ ਉਹ ਮਹਿੰਗੇ ਆ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੇ ਵਰਤਣਗੇ ਤਾਂ ਹੀ ਉਹ ਅੱਗੇ ਵੱਧ ਸਕਦੇ ਨੇ ਪਰ ਇਹ ਇੱਕ ਜਿਸ ਨੂੰ ਕਹਿੰਦੇ ਆ ਆਪਾਂ ਮਿੱਥ ਹੈ ਇੱਕ ਤਰ੍ਹਾਂ ਦਾ ਜਿਹੜਾ ਕਿ ਸੱਚ ਨਹੀਂ ਹੈ ਆਪਾਂ ਹਮੇਸ਼ਾ ਹੀ ਜਿਹੜੇ ਚਿੱਤਰਕਾਰੀ ਆ ਉਹ ਸਾਡੇ ਜਿਹੜੇ ਟੈਲੇਂਟ ਦੇ ਉੱਤੇ ਸਾਡੇ ਹੁਨਰ ਦੇ ਉੱਤੇ ਡਿਪੈਂਡ ਕਰਦਾ ਹੈ ਨਾ ਕਿ ਕਿਹੜੇ ਅਸੀਂ ਰੰਗ ਵਰਤ ਰਹੇ ਆ ਜਾਂ ਕਿਹੜੀ ਅਸੀਂ ਸ਼ੀਟ ਦੇ ਉੱਤੇ ਬਣਾ ਰਹੇ ਆ ਤਾਂ ਸਾਰੇ ਹੀ ਚਿੱਤਰਕਾਰ ਜਿਹੜੇ ਕਿ ਆਪਣੇ ਹੁਨਰ ਨੂੰ ਸੁਧਾਰਨਾ ਚਾਹੁੰਦੇ ਹਨ ਉਹਨਾਂ ਦੀ ਮੇਰੀ ਇੱਕ ਹੀ ਸਲਾਹ ਹੈ ਕਿ ਆਪਣਾ ਜਿਹੜਾ ਹੁਨਰ ਹੈ ਉਸਨੂੰ ਤੁਸੀਂ ਨਿਖਾਰਨ ਦੇ ਲੀਏ ਵਾਰ ਵਾਰ ਜਿਹੜੀ ਹੈ ਕੋਸ਼ਿਸ਼ ਕਰਦੇ ਰਹੋ ਪ੍ਰੈਕਟਿਸ ਕਰਦੇ ਰਹੋ ਤਾਂ ਕਿ ਜਿਹੜੀ ਤੁਹਾਡੀ ਚਿੱਤਰਕਾਰੀ ਉਹ ਇਕਦਮ ਨਿਖਰ ਕੇ ਆਵੇ ਮਹਿੰਗੇ ਰੰਗ ਜਾਂ ਜਿਹੜੇ ਪੇਂਟ ਬਰੱਸ਼ਿਸ਼ ਨੇ ਉਹਨਾਂ ਨਾਲ ਕੁਛ ਨਹੀਂ ਹੁੰਦਾ